ਮੈਂ ਕਾਰੋਬਾਰ ਕਰਦਾ ਹਾਂ ਮੇਰਾ ਕਾਰੋਬਾਰ ਕੱਪੜੇ ਦਾ ਹੈ ਮੈਂ ਬਾਹਰੋਂ ਕਈਆਂ ਮਿੱਲਾਂ ਦੇ ਵਿੱਚੋਂ ਮਾਲ ਡਰੈਕਟ ਮੰਗਵਾਉਂਦਾ ਹਾਂ ਅਤੇ ਕਈਆਂ ਦਾ ਕੁਛ ਸਿੱਧਾ ਮਾਲ ਨਹੀਂ ਹੁੰਦਾ ਉਹ ਏਜੰਟ ਰਾਹੀਂ ਹੁੰਦੀ ਇੱਕ ਮਿੱਲ ਕੋਲੋਂ ਮਾਲ ਲੈਣਾ ਚਾਹੁੰਦਾ ਸੀ ਉਹਦੇ ਕੋਲੋਂ ਮਾਲ ਸਿੱਧਾ ਨਹੀਂ ਸੀ ਆ ਸਕਦਾ ਕਿਸੇ ਨੂੰ ਮੈਨੂੰ ਦੱਸਿਆ ਏਜੰਟ ਨਾਲ ਗੱਲ ਕਰੋ ਏਜੰਟ ਹੈਗਾ ਏਜੰਟ ਨਾਲ ਗੱਲਬਾਤ ਕੀਤੀ ਉਹਨਾਂ ਮੇਰਾ ਉਹਦੇ ਨਾਲ ਮੇਲ ਕਰਾ ਕੇ ਉੱਥੋਂ ਮੈਨੂੰ ਮਾਲ ਮੰਗਵਾ ਕੇ ਦਿੱਤਾ ਜਿਥੇ ਪਹਿਲਾਂ ਮੈਨੂੰ ਮੁਸ਼ਕਿਲ ਆਉਂਦੀ ਸੀ ਮਾਲ ਨਹੀਂ ਸੀ ਉਹ ਲੈ ਸਕਦਾ ਮੈਂ ਏਜੰਟ ਨੇ ਮੇਰੀ ਮੁਸ਼ਕਿਲ ਹੱਲ ਕਰ ਦਿੱਤੀ